ਹੈਲੋ ਇਹ ਤਾਂ ਮੈਨੂੰ ਆ ਗਈ ਹਾਂਜੀ ਹਾਂਜੀ ਹੈਲੋ ਹੈਲੋ ਹਾਂਜੀ ਬੋਲੋ ਹਾਂ ਪੰਜ ਛੇ ਸਕੂਲ ਹੈਗੇ ਨੇ ਆਰਮੀ ਸਕੂਲ ਹੈਗਾ ਸਰਵਿਤਕਾਰੀ ਹੈਗਾ ਸੈਕਰਡ ਹਾਰਟ ਗੌਰਮਿੰਟ ਸਕੂਲ ਹੈਗਾ ਅਤੇ ਬਾਕੀ ਜਿਹੜਾ ਆਰਮੀ ਪਬਲਿਕ ਸਕੂਲ ਦਾ ਜਿਹੜਾ ਹੈਗਾ ਨਾ ਨਰਸਰੀ ਜਿਗ ਜਾਓ ਉਹ ਬੜਾ ਵਧੀਆ ਵੈਸੇ ਤਾਂ ਅਤੇ ਸਰਵਿਤਕਾਰੀ ਵੀ ਬਹੁਤ ਵਧੀਆ ਛੋਟੇ ਬੱਚਿਆਂ ਵਾਸਤੇ ਹਾਂ ਅਤੇ ਸੈਕਰਡ ਆਰਟ ਦੀ ਤਾਂ ਮੈਂ ਫੇਵਰ ਵਿੱਚ ਹੈ ਨਹੀਂ ਹੈਗਾ ਜ਼ਿਆਦਾ ਉਹ ਤਾਂ ਬੱਚੇ 'ਤੇ ਸਟਰੈਸ ਜ਼ਿਆਦਾ ਪਾਉਂਦੇ ਨੇ ਆਪਾਂ ਬੱਚੇ 'ਤੇ ਜਦ ਜਿਆਦਾ ਬੋਝ ਵੀ ਪਾਉਣਾ ਖੇਡਣ ਦਿਓ ਬਸ ਉਹਨੂੰ ਹੋਲੀ ਹਾਰਟ ਛੋਟੇ ਬੱਚਿਆਂ ਦੀ ਜੀ ਨਾ ਹੁੰਦੀ ਆਪਣਾ ਤਾਂ ਬੱਚਾ ਪੋਤਾ ਹੀ ਹੈਗਾ ਕੋਈ ਪੰਜ ਸਾਲ ਦਾ ਹਾਲੇ ਚਾਰ ਪੰਜ ਸਾਲ ਦਾ ਤਾਂ ਇਹਨੂੰ ਤਾਂ ਖੇਡਣ ਦਿਓ ਬਸ ਮੇਰੀ ਤਾਂ ਸਲਾਹ ਹੈਗਾ ਆਰਮੀ ਪਬਲਿਕ ਸਕੂਲ ਵਧੀਆ ਨਰਸਰੀ ਨਾ ਉੱਥੇ ਬੈਗ ਨਾ ਲੈਣਾ ਨਾ ਦੇਣਾ ਬਸ ਡਰੈਸ ਦੂਜੀ ਪਾ ਕੇ ਜਾਏਗਾ ਅਤੇ ਆਪਦਾ ਖੇਡ ਖੂਡ ਕੇ ਆ ਜਾਏਗਾ ਆਟੋ ਜਾਂਦੇ ਹੀ ਨੇ ਆਟੋ ਲਗਵਾ ਦਿਆਂਗੇ ਉਹਨੂੰ ਜਾਏ ਹੈਂ ਬਸ ਨਹੀਂ ਨਾ ਆਉਂਦੀ ਆਰਮੀ ਸਕੂਲ ਦੀ ਹਾਂ

ਕਾਰ ਤਾਂ ਵਾਰੀ ਵਾਰੀ ਆ ਜਾਂਦਾ ਨਾ ਬੱਚਾ ਵੀ ਅਤੇ ਪੇਰੈਂਟਸ ਵੀ ਕਿਧਰੇ ਸੁੱਖ ਦੁੱਖ 'ਚ ਵੀ ਆਉਣਾ ਜਾਣਾ ਪੈਂਦਾ ਫਿਰ ਕੀ ਕਰੇਗਾ ਬੰਦਾ

ਐਕਟੀਵਾ ਤਾਂ ਲੈ ਆਇਆ ਕਰੀ ਫਿਰ ਚਲੋ ਠੀਕ ਹੈ ਫਿਰ ਲੈ ਆਇਆ ਕਰੀਂ ਓਕੇ